ਮੈਂ ਅੱਜ ਰਾਤ ਬੈਠੀ ਕੁਝ ਕੰਮ ਕਰ ਰਹੀ ਸੀ ਅਤੇ ਅਚਾਨਕ ਹੀ ਮੇਰੇ ਫੋਨ ਦਾ ਨੈਟਵਰਕ ਸਪੀਡ ਬਹੁਤ ਹੌਲੀ ਹੋਣ ਲੱਗ ਪਈ ਜਿਸ ਦੇ ਨਾਲ ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਭਾਵ ਆਉਣ ਲੱਗ ਪਏ ਕੀ ਮੇਰਾ ਡਾਟਾ ਸੀਮਾ ਖਤਮ ਹੋਣ 'ਤੇ ਆ ਗਈ ਹੈ ਜਾਂ ਫਿਰ ਨੈਟਵਰਕ ਸਪੀਡ ਹੌਲੀ ਕਿਉਂ ਹੋ ਗਈ ਹੈ ਇਸ ਦੇ ਲਈ ਮੈਂ ਮੋਬਾਈਲ ਆਪਰੇਟਰ ਗ੍ਰਾਹਕ ਸੇਵਾ ਨੰਬਰ 'ਤੇ ਡਾਇਲ ਕੀਤਾ ਅਤੇ ਉਹਨਾਂ ਤੋਂ ਕੁਝ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨ ਨੂੰ ਕਿਹਾ ਮੈਂ ਦੱਸਿਆ ਕਿ ਮੈਂ ਕੰਮ ਕਰ ਰਹੀ ਸਾਂ ਅਤੇ ਅਚਾਨਕ ਹੀ ਮੇਰੇ ਫੋਨ ਦਾ ਡੇਟਾ ਬਹੁਤ ਹੌਲੀ ਚੱਲਣ ਲੱਗ ਪਿਆ ਇੰਟਰਨੈਟ ਸਪੀਡ ਬਿਲਕੁਲ ਹੌਲੀ ਹੋ ਗਈ ਕਿਰਪਾ ਕਰਕੇ ਤੁਸੀਂ ਮੈਨੂੰ ਜਾਂਚ ਕਰਕੇ ਦੱਸ ਸਕਦੇ ਹੋ ਕਿ ਇਸ ਵਿੱਚ ਕੀ ਦੁਵਿਧਾ ਆ ਰਹੀ ਹੈ ਜਿਸ ਨਾਲ ਮੈਨੂੰ ਕੰਮ ਕਰਨ ਵਿੱਚ ਮੁਸ਼ਕਿਲ ਵੀ ਆ ਰਹੀ ਹੈ ਅਤੇ ਮੇਰਾ ਡਾਟਾ ਵੀ ਨਹੀਂ ਚੱਲ ਰਿਹਾ ਮੈਂ ਕਿਹਾ ਕਿ ਕਿਰਪਾ ਕਰਕੇ ਤੁਸੀਂ ਮੈਨੂੰ ਚੈਕ ਕਰਕੇ ਜ਼ਰੂਰ ਦੱਸੋ ਜਿਸ ਨਾਲ ਮੈਂ ਆਪਣੇ ਕੰਮ ਨੂੰ ਲਾਗੂ ਕਰ ਸਕਾਂ